ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਤੁਹਾਡੀ ਕੈਬ ਬੁੱਕ ਕੀਤੀ ਹੋਈ ਸੀ ਕਿੱਥੇ ਹੋ ਤੁਸੀਂ ਸਰ ਇਸ ਟਾਈਮ ਨਹੀਂ ਸਰ ਮੈਂ ਇਸ ਜਿਸ ਲੋਕੇਸ਼ਨ 'ਤੇ ਮੈਂ ਤੁਹਾਨੂੰ ਭੇਜੀ ਤੁਸੀਂ ਉਸ ਲੋਕੇਸ਼ਨ ਤੋਂ ਬੜੀ ਦੂਰ ਦਿਖਾਈ ਦੇਣ ਡੇ ਹੋ ਮੈਨੂੰ ਐਪ 'ਚੋਂ ਕਿੰਨਾ ਕੁ ਟਾਈਮ ਲੱਗੇਗਾ ਸਰ ਤੁਹਾਨੂੰ ਹੋਰ ਬਟ ਸਰ ਜੇ ਟਰੈਫਿਕ ਹੈ ਤਾਂ ਮੈਂ ਆਪਣਾ ਵੇਖਣਾ ਟਾਈਮ ਮੇਰਾ ਜ਼ਿਆਦਾ ਉਹ ਹੋ ਰਿਹਾ ਵੇਸਟ ਹੋ ਰਿਹਾ ਐਕਚੁਲੀ ਮੇਰਾ ਮੈਂ ਜੇ ਤੁਹਾਨੂੰ ਜ਼ਿਆਦਾ ਟਾਈਮ ਲੱਗਣਾ ਤਾਂ ਮੈਂ ਕੈਂਸਲ ਕਰਨ ਕਰਨ ਲੱਗਾ ਇਸ ਕਰਕੇ ਕਿ ਮੈਨੂੰ ਬਹੁਤ ਹੀ ਕੰਮ ਜ਼ਰੂਰੀ ਹੈ ਜਿੱਥੇ ਮੈਂ ਜਾਣਾ ਹੈ ਬਟ ਤੁਸੀਂ ਲੇਟ ਹੋ ਜਾਣਾ ਅਤੇ ਇਸ ਕਰਕੇ ਕਿ ਮੈਂ ਕੈਂਸਲ ਕਰਾਣ ਲੱਗਾ ਪੈਸੇ ਤੁਹਾਨੂੰ ਕੋਈ ਨਹੀਂ ਮਿਲਣੇ ਇਸ ਕਰਕੇ ਕਿਉਂਕਿ ਮੇਰੀ ਕੋਈ ਇਹ 'ਚ ਗਲਤੀ ਨਹੀਂ ਹੈਗੀ ਤੁਸੀਂ ਲੇਟ ਹੋ ਮੈਂ ਤਾਂ ਨਹੀਂ ਲੇਟ ਹੈਗਾ ਇਸ ਕੰਮ 'ਚ ਮੈਂ ਤਾਂ ਆਪਣੀ ਲੋਕੇਸ਼ਨ 'ਤੇ ਅਗਜੈਕਟ ਖਲੋਤਾ ਬਟ ਤੁਸੀਂ ਵੈਸੇ ਮੈਂ ਇੱਕ ਚੀਜ਼ ਦੇਖੀ ਤੁਹਾਡੀ ਸਰਵਿਸ ਹੀ ਬਹੁਤ ਸਲੋਅ ਹੈ ਮੈਂ ਕਦੋਂ ਦੀ ਕੈਬ ਬੁੱਕ ਕੀਤੀ ਹੋਈ ਤੁਸੀਂ ਅਜੇ ਤੱਕ ਨਹੀਂ ਪੁੱਜੇ ਤਾਂ ਇਸ ਕਰਕੇ ਮੈਂ ਨੈਗਟਿਵ ਫੀਲ ਕਰ ਰਿਹਾ ਤੁਹਾਡੇ ਲਈ ਕਿ ਤੁਸੀਂ ਇੱਦਾਂ ਦੀ ਸਰਵਿਸ ਪ੍ਰੋਵਾਈਡ ਕਰਦੇ ਹੋ ਕਸਟਮਰਾਂ ਨੂੰ ਬਾਕੀ ਨੂੰ ਇਹਦਾ ਕੈਬ ਕੈਂਸਲ ਕਰ ਦਿਉ ਮੈਨੂੰ ਹੋਰ ਕੁਛ ਨਹੀਂ ਜ਼ਿਆਦਾ ਗੱਲਬਾਤ ਕਰਨੀ ਇਸ ਕਰਕੇ ਤੁਹਾਡੀ ਕੰਪਨੀ ਹੈ ਨਹੀਂ ਇੰਨੀ ਵਧੀਆ ਨਹੀਂ ਲੱਗੀ ਮੈਨੂੰ ਕਿਉਂਕਿ ਪਿਛਲੀ ਵਾਰ ਲਾਸਟ ਟਾਈਮ ਮੈਂ ਜਿਸ ਕੰਪਨੀ ਤੋਂ ਕੀਤਾ ਸੀ ਉਹਨੂੰ ਪੰਜ ਸੱਤ ਮਿੰਟ 'ਚ ਆ ਗਿਆ ਸੀ ਤੁਹਾਡਾ ਤਾਂ ਕਿੰਨਾ ਟਾਈਮ ਲੱਗ ਗਿਆ ਬਟ ਮੈਂ ਲੇਟ ਹੋ ਰਿਹਾ ਮੇਰੇ ਪੈਸੇ ਵਾਪਸ ਮੈਂ